ਮੈਂ ਫਲਿਪਕਾਡ ਤੋਂ ਓਪੋ ਦਾ ਫੋਨ ਆਡਰ ਕੀਤਾ ਸੀ ਜਿਸਦਾ ਡਿਲਵਰੀ ਸਮਾਂ ਇੱਕ ਹਫ਼ਤੇ ਦਾ ਸੀ ਪਰ ਮੈਨੂੰ ਉਹ ਦੋ ਦਿਨ ਪਹਿਲਾਂ ਹੀ ਮਿਲ ਗਿਆ ਜਿਸ ਨਾਲ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਮੈਂ ਫੋਨ ਚੁੱਕ ਕੇ ਨੱਚਦੀ ਫਿਰਾਂ ਤਾਂ ਸਭ ਨੂੰ ਦੱਸਦੀ ਫਿਰਾਂ ਫੋਨ ਮੈਨੂੰ ਮਿਲ ਵੀ ਗਿਆ ਦੁਕਾਨ ਦੇ ਰੇਟਾਂ ਤੋਂ ਘੱਟ ਰੇਟ 'ਤੇ ਮਿਲ ਗਿਆ ਸੀ ਇਸ ਵਿੱਚ ਫੀਚਰ ਵੀ ਸਾਰੀਆਂ ਹੀ ਹਨ ਅਤੇ ਫਾਈਵ ਜੀਬ ਵੀ ਹੈ ਜੋ ਕੇ ਮੈਨੂੰ ਜ਼ਰੂਰਤ ਸੀ ਉਹ ਸਾਰੀਆਂ ਐਪਸ ਵੀ ਪਹਿਲਾਂ ਹੀ ਇਸ ਵਿੱਚ ਮੌਜੂਦ ਸਨ ਮੈਂ ਇਸ ਦੀ ਰੇਟਿੰਗ ਵੀ ਫਾਈਲ ਸਟਾ ਫਾਇਵ ਸਟਾਰ ਦਿੱਤੀ ਡਿਲਵਰੀ ਬੁਆਏ ਦਾ ਵਿਹਾਰ ਵੀ ਬਹੁਤ ਵਧੀਆ ਸੀ ਮੈਂ ਸੁਣਿਆ ਸੀ ਕਿ ਆਨਲੈਨ ਚੀਜ਼ਾਂ ਵਧੀਆ ਨਹੀਂ ਮਿਲਦੀਆਂ ਪਰ ਮੈਨੂੰ ਇਹ ਬਹੁਤ ਹੀ ਵਧੀਆ ਰੰਗ ਰੂਪ ਵਿੱਚ ਮਿਲ ਗਿਆ ਜੋ ਮੈਂ ਚਾਹੁੰਦੀ ਸੀ ਸੇਮ ਉਹ ਹੀ ਆਇਆ ਅਤੇ ਮੈਂ ਇਸਨੂੰ ਦੋ ਸਾਲਾਂ ਤੋਂ ਵਰਤ ਰਹੀ ਹਾਂ